ਹਾਂਜੀ ਸਾਡੇ ਕਲਾ ਸਪਲਾਈ ਸਟੋਰ ਹੈਗੇ ਨੇ ਜਿਵੇਂ ਕਿ ਪਗੜੀ ਸੈਂਟਰ ਜਿੱਥੇ ਕਿਪੱਗ ਸਕ ਪੱਗ ਬੰਨਣੀ ਸਿਖਾਈ ਜਾਂਦੀ ਆ ਡਰਾਇੰਗ ਦੀ ਸਿਖਲਾਈ ਕੀਤੀ ਜਾਂਦੀ ਆ ਅਤੇ ਸਿੰਗਿੰਗ ਦਾ ਸੈਂਟਰ ਵੀ ਹੈਗਾ ਜਿੱਥੇ ਕਿ ਗਾਉਣ ਦਾ ਗਾਉਣਾ ਵਜਾਉਣਾ ਸਿਖਾਇਆ ਜਾਂਦਾ ਹੈ ਅਤੇ ਕਈ ਸਾਰੇ ਕੋਚਿੰਗ ਸੈਂਟਰ ਵੀ ਨੇ ਜਿਵੇਂ ਕਿ ਜਿੱਥੇ ਕਿ ਆਈਲੈਟਸ ਪੀ ਟੀ ਈ ਜਾਂ ਇੰਗਲਿਸ਼ ਸਪੀਕਿੰਗ ਸਿਖਾਈ ਜਾਂਦੀ ਆ ਅਤੇ ਮੈਨੂੰ ਜਿਹੜੀਆਂ ਸਟੇਸ਼ਨਰੀ ਚੀਜ਼ਾਂ ਨੇ ਜਿਵੇਂ ਕਾਪੀਆਂ ਕਿਤਾਬਾਂ ਖਰੀਦਣਾ ਪੈੱਨ ਸਟੈਪਲਰ ਅਤੇ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਜੋ ਕਿ ਸਟੇਸ਼ਨਰੀ ਤੋਂ ਖਰੀਦਦਾ ਉਸ ਤੋਂ ਬਾਅਦ ਜਿਵੇਂ ਕਿ ਕਲਾ ਅਤੇ ਸ਼ਿਲਪਕਾਰੀ ਦੀ ਗੱਲ ਕਰੀਏ ਤਾਂ ਮੈਨੂੰ ਕਿਤਾਬਾਂ ਪੜ੍ਹਨਾ ਲਿਖਣ ਦਾ ਸ਼ੌਂਕ ਆ ਅਤੇ ਦੇਸ਼ ਦੀ ਸਮੱਗਰੀ ਜੋ ਕਿ ਮਨ ਪਸੰਦ ਮੇਰੀ ਕਲਾ ਅਤੇ ਸ਼ਿਲਪਕਾਰੀ ਸਮੱਗਰੀ ਆ ਉਸ ਦੇ ਵਿੱਚ ਘਰੇ ਮੇਰੇ ਟੇਬਲ ਪਿਆ ਹੈ ਅਤੇ ਲਾਈਟ ਦਾ ਪ੍ਰਬੰਧ ਹੈ ਅਤੇ ਮੇਰੇ ਕੋਲ ਰਜਿਸਟਰ ਹਨ ਜੋ ਕਿ ਮੈਂ ਉੱਥੇ ਬੈਠ ਕੇ ਆਪਣੇ ਮਨ ਪਸੰਦ ਦੀਆਂ ਜੋ ਵੀ ਕੁਝ ਵੀ ਲਿਖਣਾ ਹੈ ਉਹ ਲਿਖ ਸਕਦਾ ਹਾਂ